ਵੈਸੇ ਤਾਂ ਮੈਂ ਬਹੁਤ ਸਾਰੀਆਂ ਖੇਡਾਂ ਖੇਡੀਆਂ ਹਨ ਪਰ ਮੇਰੀ ਮਨ ਪਸੰਦ ਖੇਡ ਹੈ ਵੋਲੀਬਾਲ ਵੋਲੀਬਾਲ ਮੇਰਾ ਵੱਡਾ ਭਰਾ ਖੇਡਦਾ ਹੁੰਦਾ ਸੀ ਜਦ ਮੈਂ ਛੋਟਾ ਹੁੰਦਾ ਸੀ ਤਾਂ ਮੈਂ ਉਸਨੂੰ ਦੇਖਦਾ ਸੀ ਅਤੇ ਬਚਪਨ ਤੋਂ ਹੀ ਮੇਰੀ ਦਿਲਚਸਪੀ ਵਾਲੀਬਾਲ ਵੱਧ ਵੱਧਦੀ ਗਈ ਅਤੇ ਉਸ ਤੋਂ ਬਾਅਦ ਮੈਂ ਸਟੇਟ ਪੱਧਰ ਉੱਤੇ ਵੋਲੀਬਾਲ ਖੇਡੀ ਹੈ ਵੋਲੀਬਾਲ ਖੇਡਣ ਨਾਲ ਮੇਰਾ ਮਾਨਸਿਕ ਅਤੇ ਸ਼ਰੀਰਕ ਵਿਕਾਸ ਦੋਨੋਂ ਹੋਇਆ ਹੈ ਇਸ ਨਾਲ ਮੈਂ ਜ਼ਿੰਦਗੀ ਨੂੰ ਕਿੱਦਾਂ ਜਿਉਦੇ ਹਾਂ ਉਹ ਵੀ ਸਿੱਖਿਆ ਹੈ ਅਤੇ ਇੱਕ ਅਸਲੀ ਸਪੋਟਸਮੈਨਸ਼ਿਪ ਕੀ ਹੁੰਦੀ ਹੈ ਉਹ ਵੀ ਮੈਨੂੰ ਇਸ ਖੇਡ ਤੋਂ ਪਤਾ ਹੈ ਲੱਗਿਆ ਹੈ ਕਿਉਂਕਿ ਜਦੋਂ ਤੁਸੀਂ ਟੀਮ ਨਾਲ ਰਲ ਕੇ ਖੇਡਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਟੀਮ ਨਾਲ ਕਿੱਦਾਂ ਪੇਸ਼ ਆਉਣਾ ਹੈ ਅਤੇ ਮੁਸ਼ਕਿਲ ਸਮੇਂ ਵਿੱਚ ਕਿੱਦਾਂ ਆਪਣੇ ਦਿਮਾਗ ਨੂੰ ਕੰਟਰੋਲ ਕਰਕੇ ਇਹ ਔਕੜ ਸਮੇਂ ਦਾ ਸਾਹਮਣਾ ਕਰਨਾ ਹੈ ਅਤੇ ਤਾਂ ਜੋ ਤੁਸੀਂ ਇੱਕ ਸਫਲ ਜਿੱਤ ਨੂੰ ਪ੍ਰਾਪਤ ਕਰ ਸਕੋ